ਪਟਿਆਲੇ ਵਿੱਚ ਰੁਜ਼ਗਾਰ ਦੇ ਕਾਫੀ ਤਰ੍ਹਾਂ ਦੇ ਮੁੱਖ ਸਰੋਤ ਹਨ ਜਿਵੇਂ ਕਿ ਪਟਿਆਲੇ ਵਿੱਚ ਕਾਫੀ ਤਰ੍ਹਾਂ ਦੀਆਂ ਫੈਕਟਰੀਆਂ ਹਨ ਅਤੇ ਇੱਥੇ ਸਭ ਤੋਂ ਪੁਰਾਣੀ ਫੈਕਟਰੀ ਹੈ ਜਿਸਨੇ ਲੋਕਾਂ ਨੂੰ ਪੁਰਾਣੇ ਸਮੇਂ 'ਚ ਰੁਜ਼ਗਾਰ ਦਿੱਤਾ ਹੋਇਆ ਹੈ ਜਿਸਨੂੰ ਸਕੋਟ ਫੈਕਟਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਲੰਮੇ ਸਮੇਂ ਤੋਂ ਚੱਲ ਰਹੀ ਹੈ ਅਤੇ ਇੱਥੋਂ ਦੀ ਮਿੱਟੀ ਵੀ ਉਪਜਾਊ ਹੈ ਇੱਥੇ ਖੇਤੀਬਾੜੀ ਦੇ ਵੀ ਵਧੀਆ ਸਰੋਤ ਹਨ ਘਨੋਰ ਸ਼ਹਿਰ ਵੱਲ ਕਾਫੀ ਰੁਜ਼ਗਾਰ ਦੇ ਸਾਧਨ ਹਨ ਉੱਥੇ ਕਾਫੀ ਫੈਕਟਰੀਆਂ ਹਨ ਜਿਵੇਂ ਕਿ ਉੱਥੇ ਕੱਪੜਾ ਬਣਾਉਣ ਵਾਲੀ ਫੈਕਟਰੀ ਹੈ ਅਤੇ ਸਮਿੰਟ ਦੀ ਵੀ ਕਾਫੀ ਫੈਕਟਰੀਆਂ ਹਨ ਪਟਿਆਲਾ ਸ਼ਹਿਰ ਕਾਫੀ ਚੀਜ਼ਾਂ ਤੋਂ ਮਸ਼ਹੂਰ ਹੈ ਜਿਵੇਂ ਕਿ ਪਟਿਆਲਾ ਸੂਟ ਪਟਿਆਲੇ ਦੀ ਜੁੱਤੀ ਪਟਿਆਲਾ ਪੈੱਗ ਅਤੇ ਹੋਰ ਵੀ ਬਹੁਤ ਕੁਝ ਪਟਿਆਲੇ ਵਿੱਚ ਹਰ ਤਰ੍ਹਾਂ ਦਾ ਸਮਾਨ ਮਿਲ ਜਾਂਦਾ ਹੈ ਪਟਿਆਲੇ ਵਿੱਚ ਧਾਰਮਿਕ ਸਥਾਨ ਵੀ ਬਹੁਤ ਹਨ ਜਿਵੇਂ ਕਿ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਇੱਦਾਂ ਦੇ ਧਾਰਮਿਕ ਸਥਾਨ ਪਟਿਆਲੇ ਵਿੱਚ ਬਣੇ ਹੋਏ ਹਨ ਅਤੇ ਜਿਵੇਂ ਸ਼ੀਸ਼ ਮਹਿਲ ਇੱਥੋਂ ਦੇ ਲੋਕ ਸਰਕਾਰੀ ਨੌਕਰੀਆਂ ਵਿੱਚ ਵੀ ਦਿਲਚਸਪੀ ਰੱਖਦੇ ਹਨ ਕਾਫੀ ਵਿਦਿਆਰਥੀ ਦੂਰ ਦੂਰ ਤੋਂ ਇੱਥੋਂ ਪੜ੍ਹਨ ਲਈ ਆਉਂਦੇ ਹਨ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੀ ਪ੍ਰਸਿੱਧ ਅਤੇ ਬਹੁਤ ਬੜੀ ਯੂਨੀਵਰਸਿਟੀ ਹੈ ਉੱਥੇ ਕਾਫੀ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ